ਟੈਕਨੋਲਜੀ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਅੱਜ ਦੇ ਜ਼ਮਾਨੇ ਵਿੱਚ ਅੱਜ ਦੇ ਟਾਈਮ ਵਿੱਚ ਤਾਂ ਕਿ ਹਰੇਕ ਕਾਰੋਬਾਰੀ ਲਈ ਬਹੁਤ ਹੀ ਮਹੱਤਵਪੂਰਨ ਚੀਜ਼ ਇਹ ਹਰ ਇੱਕ ਤਰ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਵਿੱਚ ਉਤਸ਼ਾਹਿਤ ਕਰਦੀ ਜਿਵੇਂ ਕਿ ਯੂਟਿਊਬ ਜੇਕਰ ਆਪਾਂ ਕੋਈ ਵੀ ਉਤਪਾਦਨ ਕਰਦੇ ਹਾਂ ਕਿਸੇ ਤਰੀਕਾ ਆਪਾਂ ਨੂੰ ਨਹੀਂ ਆ ਰਿਹਾ ਤਾਂ ਅਸੀਂ ਯੂਟੀਊਬ ਦੀ ਮਦਦ ਨਾਲ ਉਸ ਬਾਰੇ ਜਾਣਕਾਰੀ ਲੈ ਸਕਦੇ ਹਾਂ ਯੂਟੀਊਬ ਉੱਪਰ ਹਰੇਕ ਤਰ੍ਹਾਂ ਦੀ ਟੋਪਿਕ ਉੱਤੇ ਹਰ ਤਰ੍ਹਾਂ ਦੀ ਵੀਡੀਓ ਬਣੀ ਹੋਈ ਹੈ ਜਿਸ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਕੋਈ ਚੀਜ਼ ਬਣਾਉਣ ਵਿੱਚ ਕਿਹੜੀ ਸਮੱਗਰੀ ਦੀ ਲੋੜ ਪੈਂਦੀ ਹੈ ਅਤੇ ਕਿਵੇਂ ਉਹ ਚੀਜ਼ ਬਣਦੀ ਹੈ